ਪੰਜਾਬ 'ਚ ਜਦੋਂ ਵੀ ਕੋਈ ਸਲਾਨੀ ਆਵੇ ਤਾਂ ਮੇਰੇ ਹਿਸਾਬ ਦੇ ਨਾਲ ਉਹ ਤਾਂ ਜ਼ਿਆਦਾ ਇੱਥੋਂ ਦੇ ਆਪਣਾ ਜਿਵੇਂ ਕਿ ਜਲ੍ਹਿਆਂਵਾਲਾ ਬਾਗ ਹੋ ਗਿਆ ਹਰਿਮੰਦਰ ਸਾਹਿਬ ਹੋ ਗਿਆ ਆਪਣਾ ਅਟਾਰੀ ਬੋਡਰ ਹੋ ਗਿਆ ਇਸ ਤੋਂ ਇਲਾਵਾ ਆਪਣਾ ਇੱਥੇ ਕੀ ਅਜੈਬ ਅਜਾਇਬ ਘਰ ਹੋ ਗਿਆ ਉਸ ਤੋਂ ਇਲਾਵਾ ਚ ਪ ਪੰਜਾਬ ਹਵੇਲੀ ਜਿਹੜੀ ਆ ਉੱਥੇ ਜਾਵੇ ਉਹ ਪੰਜਾਬੀ ਦੀ ਹਵੇਲੀ ਦੇ ਵਿੱਚ ਦੇਖੋ ਉੱਥੇ ਤੇ ਸਾਰਾ ਦਿਖਾਇਆ ਗਿਆ ਉਤੇ ਪੰਜਾਬੀ ਵਿਰਸਾ ਦਿਖਾਇਆ ਗਿਆ ਉੱਥੇ ਜਿਵੇਂ ਕਿ ਸਾਡਾ ਪੰਜਾਬੀ ਕਲਚਰ ਪੂਰਾ ਦਿਖਾਇਆ ਗਿਆ ਹੈ ਪੰਜਾਬੀ ਕਲਚਰ ਦੇ ਨਾਲ ਨਾਲ ਸਾਡਾ ਜਿਹੜਾ ਸਾਡਾ ਖਾਣ ਪਾਣ ਸਾਡਾ ਰਹਿਣ ਸਹਿਣ ਖੇਤੀਬਾੜੀ ਵੀ ਦੇ ਬਾਰੇ ਵੀ ਦੱਸਿਆ ਗਿਆ ਪੂਰਾ ਇਸ ਤੋਂ ਇਲਾਵਾ ਆਪਣਾ ਸਾਡੇ ਪਿੰਡ ਦੇ ਵਿੱਚ ਤਾਂ ਬੋ ਸਾਰਾ ਪੰਜਾਬ ਦਾ ਪੂਰਾ ਵਿਰਸਾ ਦਿਖਾਇਆ ਗਿਆ ਗੋਬਿੰਦਗੜ੍ਹ ਕਿਲ੍ਹੇ ਦੇ ਵਿੱਚ ਜਾਵੇ ਗੋਬਿੰਦਗੜ੍ਹ ਕਿਲ੍ਹੇ ਦੇ ਵਿੱਚ ਤਾਂ ਗੁਰੂ ਸਾਹਿਬਾਨਾਂ ਦੇ ਪੂਰੇ ਪੂਰੇ ਉਹਨਾਂ ਦਾ ਪੂਰਾ ਦਰਸਾਇਆ ਗਿਆ ਇਸ ਤੋਂ ਇਲਾਵਾ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਕਿ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਸੀ ਉੱਥੇ ਰਾਮਦਾਸ ਜੀ ਦੇ ਨਾਮ ਤੋਂ ਹੀ ਇੱਥੇ ਉਹਨਾਂ ਦਾ ਨਾਮ ਹਰਿਮੰਦਰ ਸਾਹਿਬ ਪੈ ਗਿਆ ਹਰਿਮੰਦਰ ਸਾਹਿਬ ਮਤਲਬ ਹਰ ਦਾ ਮੰਦਰ ਹਰ ਦਾ ਘਰ ਭਗਵਾਨ ਦਾ ਘਰ ਉਸ ਤੋਂ ਇਲਾਵਾ ਜਲ੍ਹਿਆਂਵਾਲੇ ਬਾਗ ਜਿਹੜਾ ਚੁਰਾਸੀ ਦਾ ਕਾਂਡ ਹੋਇਆ ਸੀ ਉਹ ਚੁਰਾਸੀ ਦੇ ਕਾਂਢ ਦੇ ਕਰਕੇ ਜਲ੍ਹਿਆਂ ਵਾਲਾ ਬਾਗ ਬਹੁਤ ਹੀ ਜ਼ਿਆਦਾ ਇਤਿਹਾਸਿਕ ਸਥਾਨ ਹੈ ਉੱਥੇ ਜਾਣਾ ਚਾਹੀਦਾ ਹੈ ਉੱਥੇ ਜਾ ਕੇ ਕਿੰਨੇ ਲੋਕ ਸ਼ਹੀਦ ਹੋਏ ਸਨ ਤੇ ਉਹਦੇ ਉਹਦੀ ਉਹ ਪੂਰੀ ਪੂਰੀ ਜਾਣਕਾਰੀ ਉੱਥੇ ਜਾ ਕੇ ਹੀ ਮਿਲੇਗੀ